ਭੰਗੜਾ ਸਾਡੇ ਪੰਜਾਬ ਦਾ ਲੋਕ ਨਾਚ ਹੈ ਇਹ ਬਹੁਤ ਪ੍ਰਚਲਿਤ ਲੋਕ ਨਾਚ ਹੈ ਜੋ ਕਿ ਪੰਜਾਬ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਵਿੱਚ ਪਾਇਆ ਜਾਣ ਲੱਗ ਪਿਆ ਹੈ ਇਸ ਨੂੰ ਗੱਭਰੂ ਅਤੇ ਮੁਟਿਆਰਾਂ ਵੀ ਸ਼ੌਂਕ ਵਜੋਂ ਪਾਉਂਦੀਆਂ ਹਨ ਭੰਗੜਾ ਕਿਸੇ ਵੀ ਖੁਸ਼ੀ ਦੇ ਮੌਕੇ 'ਤੇ ਪਾਇਆ ਜਾਂਦਾ ਹੈ ਇਹ ਵਿਆਹਾਂ ਦੇ ਮੌਕੇ ਵੀ ਪਾਇਆ ਜਾਂਦਾ ਹੈ ਇਹ ਦੁਨੀਆ ਭਰ ਦੇ ਹਰ ਇੱਕ ਸ਼ਹਿਰ ਗਲੀ ਮੁਹੱਲੇ ਵਿੱਚ ਪਾਇਆ ਜਾਂਦਾ ਹੈ ਇਹ ਬਹੁਤ ਸੁੰਦਰ ਅਤੇ ਜੋਸ਼ ਵਾਲਾ ਨਾਚ ਹੈ ਭੰਗੜਾ ਇੱਕ ਸਮੁਦਾਇਕ ਲੋਕ ਨਾਚ ਵੀ ਹੈ ਗੱਭਰੂ ਅਤੇ ਮੁਟਿਆਰਾਂ ਇਸ ਨੂੰ ਟੋਲੀ ਜਾਂ ਗਰੁੱਪ ਬਣਾ ਕੇ ਵੀ ਪਾਉਂਦੀਆਂ ਹਨ ਇਹ ਤਿਉਹਾਰਾਂ ਜਿਵੇਂ ਕਿ ਲੋਹੜੀ ਤੀਆਂ ਅਤੇ ਜਾਗੋ ਆਦਿ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਗਿਆ ਹੈ